ਡਾਂਸ ਲੋਕਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਇੱਦਾਂ ਕਰਦਾ ਵਾ ਕਿ ਜਿਵੇਂ ਆਪਾਂ ਜਦੋਂ ਡਾਂਸ ਕਰਦੇ ਹਾਂ ਅਤੇ ਸਾਡੀਆਂ ਨਾੜਾਂ ਖੁੱਲ੍ਹਦੀਆਂ ਵਾ ਸਾਡੇ ਹੱਡੀਆਂ ਮਜ਼ਬੂਤ ਹੁੰਦੀਆਂ ਅਸੀਂ ਸਾਰਿਆਂ ਨੂੰ ਇਹ ਚੀਜ਼ ਦੱਸਣਾ ਚਾਹੁੰਦੇ ਹਾਂ ਕਿ ਜਿੱਦਾਂ ਅਸੀਂ ਜਦੋਂ ਡਾਂਸ ਕਰੀਏ ਆਪਣੀਆਂ ਲੱਤਾਂ ਬਾਹਾਂ ਜੋ ਵੀ ਆਪਾਂ ਨੂੰ ਲੱਗਦਾ ਕਿ ਆਪਾਂ ਨਹੀਂ ਜ਼ਿਆਦਾ ਤੁਰ ਸਕਦੇ ਜਿਹਨਾਂ ਲੋਕਾਂ ਦੀਆਂ ਗੋਡੇ ਵੀ ਦੁਖਦੇ ਜਦੋਂ ਆਪਾਂ ਜਦੋਂ ਜਿਹੜੀ ਚੀਜ਼ ਨੂੰ ਜ਼ਿਆਦਾ ਹਿਲਾਵਾਂਗੇ ਉਹ ਚੀਜ਼ ਨੇ ਵਾਕਈ ਪੀਪ ਆਪਣਾ ਪੂਰਾ ਠੀਕ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਾ ਵਾ ਅਤੇ ਉਹ ਆਪਣੇ ਲਈ ਸਿਹਤਮੰਦ ਹੁੰਦਾ ਵਰਜ਼ਿਸ ਕਰਨ ਦੀ ਲੋੜ ਨਹੀਂ ਪੈਂਦੀ ਜੇ ਆਪਾਂ ਡਾਂਸ ਕਰਦੇ ਰਹੀਏ ਤਾਂ ਅਤੇ ਵਧੀਆ ਲੱਗਦਾ ਉਹਨਾਂ ਵੀ ਮਜ਼ਾ ਆਉਂਦਾ ਵਾ ਕਰਨ ਵਿੱਚ ਨੱਚਣ ਵਿੱਚ ਅਤੇ ਵਧੀਆ ਖੁਸ਼ੀ ਮਹਿਸੂਸ ਹੁੰਦੀ ਆ ਅਤੇ ਲੋਕ ਸਾਰੇ ਹੀ ਡਾਂਸ ਕਰਨ ਸਮੇਂ ਇੱਦਾਂ ਮਹਿਸੂਸ ਕਰਦੇ ਆਪਣੇ ਸਾਰੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਆ ਅਤੇ ਇੰਨੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਟੈਂਸ਼ਨਾਂ ਦੂਰ ਹੁੰਦੀਆਂ ਵਾ ਹਰ ਇੱਕ ਚੀਜ਼ ਵਧੀਆ ਲੱਗਦੀ ਆ ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਫਰੀ ਜੇ ਘਰ ਵਿੱਚ ਤਾਂ ਹਮੇਸ਼ਾ ਡੈਕ ਜਾਂ ਕੋਈ ਟੀ ਵੀ ਸੀ ਡੀ ਕੁਝ ਲਗਾ ਕੇ ਜ਼ਰੂਰ ਡਾਂਸ ਕਰ ਕਰਦੇ ਰਿਹਾ ਕਰੋ ਅਤੇ ਇਹਦੇ ਨਾਲ ਤੁਹਾਡਾ ਮਨ ਵੀ ਠੀਕ ਰਹੇਗਾ ਤੁਹਾਡੀ ਸਿਹਤ ਵਧੀਆ ਰਹੇਗੀ ਅਤੇ ਇਹਦੇ ਨਾਲ ਤੁਹਾਡਾ ਵੀ ਤੁਹਾਨੂੰ ਖੁਸ਼ੀ ਮਿਲੇਗੀ ਤੁਹਾਡੇ ਬੱਚੇ ਵੀ ਵਧੀਆ ਰਹਿਣਗੇ ਨਾਲ ਤੁਸੀਂ ਆਪਣੇ ਬੱਚਿਆਂ ਨਾਲ ਕਲ ਕਲਚਰ ਨਾਲ ਜੋੜ ਸਕਦੇ ਜੀ ਉਹਨਾਂ ਨੂੰ ਗਿੱਧੇ ਭੰਗੜੇ ਨਾਲ ਜੋੜ ਸਕਦੇ ਜੀ ਇਸ ਲਈ ਤੁਸੀਂ ਡਾਂਸ ਜ਼ਰੂਰ ਕਰਿਆ ਕਰੋ